ਸਾਡੇ ਖੇਤਰ ਵਿੱਚ ਨੁਮਾਇੰਦਗੀ ਕਰਨ ਵਾਲੀਆਂ ਖੇਡਾਂ ਹੁੰਦੀਆਂ ਹਨ ਇਹ ਖੇਡਾਂ ਵਿੱਚ ਕਈ ਲੋਕ ਜਿੱਤਦੇ ਹਨ ਅਤੇ ਕਈ ਲੋਕ ਜ਼ਖਮੀ ਹ ਹੁੰਦੇ ਹਨ ਖੇਡਾਂ ਦੇ ਅਲੱਗ ਅਲੱਗ ਤਰੀਕੇ ਨਾਲ ਅਲੱਗ ਅਲੱਗ ਪੜਾਅ ਹੁੰਦੇ ਹਨ ਜਿਸ ਵਿੱਚ ਖਿਡਾਰੀਆਂ ਨੂੰ ਚੋਟਾਂ ਵੀ ਲੱਗਦੀਆਂ ਹਨ ਸ ਚੋਟਾਂ ਦਾ ਕ ਮੁੱਖ ਕਾਰਨ ਬਣਦਾ ਹੈਗਾ ਜਿਵੇਂ ਕਿ ਜਿਹੜੀ ਉਹ ਗਰਾਊਂਡ ਹੁੰਦਾ ਆ ਉਹ ਪੂਰੀ ਤਰ੍ਹਾਂ ਸੁੱਕਾ ਹੋਣਾ ਚਾਹੀਦਾ ਆ ਉਹਦੇ ਵਿੱਚ ਜਿਹੜੇ ਆ ਖੱਡੇ ਨਹੀਂ ਹੋਣੇ ਚਾਹੀਦੇ ਗੇ ਠੀਕ ਆ ਅਤੇ ਹੈ ਨਾ ਪੂਰੀ ਸਫਾਈ ਜਿਹੜਾ ਘਾਹ ਹੁੰਦਾ ਉਹ ਬੜਾ ਬੜਾ ਨਹੀਂ ਹੋਣਾ ਚਾਹੀਦਾਗਾ ਇਸ ਕਾ ਇਸ ਦੇ ਨਾਲ ਮੈਦਾਨ ਦਾ ਜਿਹੜਾ ਲੈਵਲ ਆ ਉਹ ਵੀ ਵਧੀਆ ਹੋਣਾ ਚਾਹੀਦਾ ਹੈ ਠੀਕ ਹੈ ਅਤੇ ਉੱਥੇ ਜਿਹੜੀ ਡਾਕਟਰਾਂ ਦੀ ਮੁਢ ਮੁੱਢਲੀ ਸਹਾਇਤਾ ਵੀ ਉਹ ਉਹ ਡ ਵਧੀਆ ਡਾਕਟਰ ਉੱਥੇ ਉਪਲਬਧ ਹੋਣੇ ਚਾਹੀਦੇ ਨੇ ਕਿ ਜਦੋਂ ਵੀ ਕਿਸੇ ਖਿਡਾਰੀ ਦੇ ਸੱਟ ਲੱਗੇ ਤਾਂ ਡਾਕਟਰ ਜਦੇ ਉਸਨੂੰ ਮੁੱਢਲੀ ਸਹਾਇਤਾ ਜਾਂ ਆਪਣਾ ਇਲਾਜ ਸ਼ੁਰੂ ਕਰ ਸਕੇ ਤਾਂ ਕਿ ਖਿਡਾਰੀ ਦੀ ਜਿਹੜੀ ਜਾਨ ਆ ਉਹ ਬਚ ਸਕੇ ਅਤੇ ਜਿਵੇਂ ਕਿ ਖੇਡਾਂ ਹੁੰਦੀਆਂ ਨੇ ਹੋਕੀ ਦੀ ਖੇਡ ਹੋ ਗਈ ਫੁੱਟਬਾਲ ਦੀ ਖੇਡ ਹੋ ਗਈ ਵਾਲੀਬਾਲ ਦੀ ਖੇਡ ਹੋ ਗਈ ਕਬੱਡੀ ਹੋ ਗਈ ਕਬੱਡੀ ਵਿੱਚ ਜ਼ਿਆਦਾਤਰ ਜ਼ਿਆਦਾਤਰ ਸੱਟਾਂ ਜਾਂ ਦੁਰਘਟਨਾਵਾਂ ਹੁੰਦੀਆਂ ਨੇ ਠੀਕ ਆ ਇਹਨਾਂ ਵਿੱਚ ਖਿਡਾਰੀਆਂ ਨੂੰ ਬਹੁਤ ਵਧੀਆ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਜਿਵੇਂ ਹੋਕੀ ਹੋ ਗਈ ਹੋਕੀ ਦੀ ਬੋਲ ਲੱਗ ਗਈ ਕਈ ਵਾਰ ਜਾਂ ਹੋਕੀ ਲੱਗ ਗਈ ਇਹ ਇਸ ਇਸ ਦਰਘਟਨਾਵਾਂ ਤੋਂ ਬਚਣ ਲਈ ਸਾਨੂੰ ਮੁੱਢਲੀ ਸਹਾਇਤਾ ਜਾਂ ਡਾਕਟਰ ਦ ਡਾਕਟਰ ਦਾ ਵਧੀਆ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਅਤੇ ਜੇਕਰ ਕਿਸੇ ਖਿਡਾਰੀ ਦੇ ਜ਼ਿਆਦਾ ਚੋਟ ਲੱਗਦੀ ਹੈ ਤਾਂ ਐਬੂਲੈਂਸ ਦਾ ਪ੍ਰਬੰਧ ਵੀ ਹੋਣਾ ਜ਼ਰੂਰੀ ਹੈ